ਮੋਹਾਲੀ ਜ਼ਿਲ੍ਹੇ ਦਾ ਮੌਸਮ ਬਹੁਤ ਹੀ ਵਧੀਆ ਹੈ ਇੱਥੋਂ ਦਾ ਮੌਸਮ ਲਗਭਗ ਸਾਫ਼ ਹੀ ਰਹਿੰਦਾ ਹੈ ਨਾ ਹੀ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਨਾ ਹੀ ਜ਼ਿਆਦਾ ਸਰਦੀ ਹੁੰਦੀ ਹੈ ਪਹਾੜੀ ਇਲਾਕੇ ਤੋਂ ਪ੍ਰਭਾਵਿਤ ਹੋਣ ਦੇ ਕਾਰਨ ਇੱਥੇ ਜ਼ਿਆਦਾਤਰ ਸਾਫ਼ ਸੁਥਰਾ ਮੌਸਮ ਹੀ ਰਹਿੰਦਾ ਹੈ ਅਤੇ ਇੱਥੋਂ ਦਾ ਮੌਸਮ ਠੰਡਾ ਰਹਿੰਦਾ ਹੈ ਅਤੇ ਮੌਸਮ ਦੀ ਤਬਦੀਲੀ ਇਸ ਸਾਲ ਦੇਖਣ ਨੂੰ ਮਿਲੀ ਹੈ ਜਿਸਦੇ ਕਾਰਨ ਭਾਰੀ ਵਰਖਾ ਦੇ ਕਾਰਨ ਮੋਹਾਲੀ ਜ਼ਿਲ੍ਹੇ ਵਿੱਚ ਹੜ੍ਹ ਦੇ ਚਾਂਸਿਸ ਵੀ ਵਧੇ ਹਨ ਅਤੇ ਮੋਹਾਲੀ ਜ਼ਿਲ੍ਹੇ ਨੂੰ ਹੜ੍ਹ ਦਾ ਸਾਹਮਣਾ ਵੀ ਕਰਨਾ ਪਿਆ ਹੈ ਜਿਸ ਦੇ ਕਾਰਨ ਮੋਹਾਲੀ ਜ਼ਿਲ੍ਹੇ ਦਾ ਮੌਸਮ ਇਸ ਵਾਰ ਗਰਮੀਆਂ ਲੰਬੀਆਂ ਚੱਲੀਆਂ ਹਨ